ਕੈਬ ਦੀ ਬੁਕਿੰਗ ਕਰਨੀ ਹੈ ਅਸੀਂ ਤਰਨ ਤਾਰਨ ਦਰਬਾਰ ਸਾਹਿਬ ਬਾਜ਼ਾਰ ਵਿੱਚ ਰਹਿੰਦੇ ਹਾਂ ਅਸੀਂ ਅੰਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ ਜਾਣਾ ਹੈ ਅਤੇ ਸਾਨੂੰ ਉਹ ਵਾਹਨ ਜਲਦੀ ਪਹੁੰਚਾ ਜਿਹੜਾ ਸਾਡੇ ਨਜ਼ਦੀਕ ਹੈ ਸਾਡੇ ਘਰ ਬਾਹਰ ਤੋਂ ਪਰਾਉਣੇ ਆਏ ਹੈ ਅਤੇ ਉਹਨਾਂ ਨੇ ਸ਼ਾਮ ਨੂੰ ਵਾਪਸ ਜਾਣਾ ਹੈ ਅਤੇ ਉਹ ਅੰਮ੍ਰਿਤਸਰ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਅਤੇ ਜਲ੍ਹਿਆਂਵਾਲਾ ਬਾਗ ਜਾਂ ਬਾਰਡਰ ਜਾਣਾ ਹੈ ਇਸ ਲਈ ਜਿਹੜਾ ਵਾਹਨ ਸਾਡੇ ਘਰ ਸ਼੍ਰੀ ਦਰਬਾਰ ਸਾਹਿਬ ਮੇਨ ਬਾਜ਼ਾਰ ਤਰਨ ਤਾਰਨ ਦੇ ਕੋਲ ਹੈ ਉਹ ਜਿੰਨੀ ਜਲਦੀ ਹੋ ਸਕੇ ਆਵੇ ਅਤੇ ਸਾਨੂੰ ਦੱਸੋ ਕਿਹੜਾ ਵਾਹਨ ਜਾਂ ਆਟੋ ਸਾਡੇ ਘਰ ਦੇ ਪਾਸ ਹੈ ਅਸੀਂ ਤਰਨ ਤਾਰਨ ਦੇ ਬਾਜ਼ਾਰ ਵਿੱਚ ਸਮਾਨ ਖਰੀਦਣਾ ਹੈ ਉੱਥੋਂ ਦੇ ਇਤਿਹਾਸ ਦੀ ਸੱਭਿਆਚਾਰਕ ਪਹਿਰਾਵੇ ਨੂੰ ਵੇਖਣਾ ਹੈ ਅਤੇ ਇਸ ਬਾਰੇ ਜਾਣਕਾਰੀ ਲੈਣੀ ਹੈ ਸਾਨੂੰ ਇਹੋ ਜਿਹੀ ਕੈਬ ਬੁੱਕ ਕਰਵਾ ਦਿਓ